ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਸੇ ਤਾਂ ਇੰਟਰਨੈਟ ਦੀ ਸ਼ੁਰੂਆਤ ਉੱਨੀ ਸੌ ਸੱਠ ਵਿੱਚ ਹੋਈ ਸੀ ਪਰ ਆਮ ਲੋਕਾਂ ਲਈ ਇਹ ਉੱਨੀ ਸੌ ਨੱਬੇ ਵਿੱਚ ਉਪਲੱਬਧ ਹੋਇਆ ਸੀ ਭਾਰਤ ਵਿੱਚ ਇੰਟਰਨੈਟ ਪੰਦਰਾਂ ਅਗਸਤ ਉੱਨੀ ਸੌ ਪਚਾਨਵੇਂ ਨੂੰ ਸਰਕਾਰੀ ਤੌਰ 'ਤੇ ਬੀ ਐਸ ਐਨ ਅਲ ਵੱਲੋਂ ਸ਼ੁਰੂ ਕੀਤਾ ਗਿਆ ਸੀ ਅਤੇ ਦੂਜਾ ਮੈਂ ਇੰਟਰਨੈਟ ਚਲਾਉਣਾ ਸ਼ੁਰੂ ਕੀਤਾ ਸੀ ਦੋ ਹਜ਼ਾਰ ਬਾਰ੍ਹਾਂ ਵਿੱਚ ਕਿਉਂਕਿ ਮੇਰਾ ਜਨਮ ਦੋ ਹਜ਼ਾਰ ਛੇ ਦਾ ਹੈ ਅਤੇ ਮੈਂ ਜਦੋਂ ਛੇ ਸਾਲਾਂ ਦੀ ਸੀ ਤੇਰੇ ਅਤੇ ਮੇਰੇ ਮੰਮਾ ਉਹ ਮੈਨੂੰ ਪੜ੍ਹਾਉਂਦੇ ਸੀ ਇੰਟਰਨੈਟ ਦੇ ਥਰੂ ਥੋੜ੍ਹਾ ਬਹੁਤ ਲਾਇਕ ਜਿਵੇਂ ਕੋਈ ਮਤਲਬ ਦੇਖ ਲਿਆ ਉੱਦਾਂ ਉਸ ਵਾਸਤੇ ਪੜ੍ਹਾਉਂਦੇ ਸੀ ਅਤੇ ਹੁਣ ਤਾਂ ਸਾਡੀ ਸਾਰੀ ਜ਼ਿੰਦਗੀ ਹੀ ਸਾਰਾ ਕੰਮ ਹੀ ਇੰਟਰਨੈਟ 'ਤੇ ਹੁੰਦਾ ਹੈ ਅਤੇ ਸਾਰਾ ਟਾਈਮ ਅਸੀਂ ਇੰਟਰਨੈਟ 'ਤੇ ਹੀ ਆਨਲਾਈਨ ਹੁੰਦੇ ਹਾਂ ਕਿ ਕੋਈ ਨਾ ਕੋਈ ਸਾਨੂੰ ਪੜ੍ਹਨ ਵਾਸਤੇ ਕੋਈ ਜ਼ਰੀਆ ਲੱਭ ਜਾਵੇ ਵੀ ਅਸੀਂ ਵਧੀਆ ਨੰਬਰਾਂ ਨਾਲ ਪਾਸ ਹੋ ਸਕੀਏ ਅਤੇ ਵਧੀਆ ਅੰਕ ਲੈ ਸਕੀਏ ਅਤੇ ਦੂਜਾ ਉਸ ਸਮੇਂ ਜਿਵੇਂ ਮੇਰੇ ਮਾਤਾ ਪਿਤਾ ਮੇਰੇ ਦਾਦਾ ਦਾਦੀ ਦੱਸਦੇ ਹੁੰਦੇ ਆ ਉਸ ਸਮੇਂ ਇੰਟਰਨੈਟ ਦੀ ਸਪੀਡ ਬਹੁਤ ਜ਼ਿਆਦਾ ਹੌਲੀ ਸੀ ਜਿਵੇਂ ਉੱਨੀ ਸੌ ਨੱਬੇ ਵਿੱਚ ਡਾਇਲਪ ਕਨੈਕਸ਼ਨ ਆਉਂਦਾ ਹੁੰਦਾ ਸੀ ਉਹ ਸਭ ਤੋਂ ਆਮ ਸੀ ਜੋ ਫੀਫਟੀ ਸਿਕਸ ਕੇ ਬੀ ਏ ਪੀ ਐਸ ਤੱਕ ਜਿਹੜੀ ਹੈ ਉਹਦੀ ਸਪੀਡ ਹੁੰਦੀ ਸੀ ਅਤੇ ਉਹ ਟੈਲੀਫੋਨ ਲਾਈਨਾਂ 'ਤੇ ਚੱਲਦਾ ਸੀ ਅਤੇ ਇਸ ਨੂੰ ਕਨੈਕਟ ਕਰਨ ਲਈ ਮਾਡਮ ਦੀ ਲੋੜ ਹੁੰਦੀ ਸੀ ਅਤੇ ਜਦੋਂ ਇੰਟਰਨੈਟ ਚੱਲ ਰਿਹਾ ਹੁੰਦਾ ਤਾਂ ਟੈਲੀਫੋਨ ਵਰਤਣਾ ਸੰਭਵ ਨਹੀਂ ਹੁੰਦਾ ਸੀ ਪੰਨੇ ਲੋਡ ਹੋਣ ਵਿੱਚ ਵੀ ਕਾਫ਼ੀ ਸਮਾਂ ਲੱਗਦਾ ਸੀ ਅਤੇ ਇੱਕ ਗਾਣਾ ਡਾਊਨਲੋਡ ਕਰਨ ਲਈ ਤ ਘੰਟੇ ਲੱਗਦੇ ਹੁੰਦੇ ਸੀ ਅਤੇ ਜੇ ਕਿਸੇ ਦੇ ਕਿਤੇ ਮੂਵੀ ਦੇਖਣੀ ਹੋਵੇ ਫੋਨ 'ਤੇ ਪੁਰਾਣੇ ਜ਼ਮਾਨੇ ਵਿੱਚ ਮੂਵੀਆਂ ਲੋਕ ਦੇਖਦੇ ਹੀ ਸੀਗੇ ਮਤਲਬ ਜਿਹੜੀ ਕਾਲੇ ਅਤੇ ਚਿੱਟੇ ਰੰਗ ਦੇ ਵਰਜ਼ਨ ਵਿੱਚ ਹੁੰਦੀ ਸੀਗੀ ਅਤੇ ਉਹ ਲੋਕ ਦੇਖਦੇ ਸੀ ਅਤੇ ਉਹਨੂੰ ਤਾਂ ਪੂਰਾ ਪੂਰਾ ਦਿਨ ਹੀ ਲੱਗ ਜਾਂਦਾ ਸੀ ਅਤੇ ਜੇ ਉਹਨਾਂ ਨੇ ਜਦੋਂ ਉਹਨਾਂ ਨੇ ਸ਼ਨੀਵਾਰ ਐਤਵਾਰ ਜਿਵੇਂ ਉਹਨਾਂ ਦੀ ਛੁੱਟੀ ਹੁੰਦੀ ਸੀ ਕੰਮਾਂ ਤੋਂ ਅਤੇ ਉਹ ਵੀਰਵਾਰ ਹੀ ਆਪਣਾ ਜਿਹੜਾ ਹੈ ਉਹਨੂੰ ਡਾਊਨਲੋਡ ਕਰਨਾ ਲਗਾ ਦਿੰਦੇ ਸੀ ਵੀ ਅਸੀਂ ਸ਼ਨੀਵਾਰ ਐਤਵਾਰ ਆਰਾਮ ਨਾਲ ਬੈਠ ਕੇ ਉਹਨੂੰ ਦੇਖ ਸਕੀਏ ਅਤੇ ਦੂਜਾ ਹੁਣ ਦੇ ਇੰਟਰਨੈਟ ਦੀ ਜਿਹੜੀ ਸਪੀਡ ਦੇਖੀਏ ਹੁਣ ਫਾਈਵ ਜੀ ਇੰਟਰਨੈਟ ਆ ਚੁੱਕੇ ਨੇ ਅਤੇ ਹੁਣ ਦੇ ਇੰਟਰਨੈਟ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਪਹਿਲਾਂ ਨਾਲੋਂ ਕਿ ਹੁਣ ਵੈਸੇ ਵੀ ਜਿਹੜਾ ਮੀ ਸਾਡਾ ਟੈਕਨੋਲ ਟੈਕਨੋਲੋਜੀ ਹੈ ਉਹ ਅੱਗੇ ਅੱਗੇ ਵੱਧ ਰਹੀ ਹੈ ਅਤੇ ਹੁਣ ਪਤਾ ਹੀ ਹੈ ਕਿ ਅੱਗੇ ਵੀ ਬਹੁਤ ਜ਼ਿਆਦਾ ਸਾਨੂੰ ਇੰਟਰਨੈਟ ਜਿਹੜਾ ਹੈ ਲੋੜ ਪਵੇਗੀ ਅਤੇ ਹੋਰ ਉਹਦੀ ਸਪੀਡ ਵਧੇਗੀ ਅਤੇ ਜਿਹੜੀ ਹੁਣ ਜਿਹੜੀ ਹੈ ਉਹ ਫਾਈਲਾਂ ਹੁਣ ਜਿਹੜੀਆਂ ਪਿਚਰਾਂ ਦੋ ਦੋ ਮਿੰਟ 'ਚ ਡਾਊਨਲੋਡ ਹੋ ਜਾਂਦੀਆਂ ਜਿਹੜਾ ਇਕ ਜੇ ਕਿਸੇ ਨੂੰ ਤੁਸੀਂ ਕੋਈ ਕੰਮ ਆਪਣਾ ਸੈਂਡ ਕਰਨਾ ਹੋਵੇ ਜਿਹਨੂੰ ਤੁਸੀਂ ਆਪਣਾ ਕੰਮ ਕਿਸੇ ਨੂੰ ਭੇਜਣਾ ਹੋਵੇ ਉਹ ਤਾਂ ਇੱਕ ਸੈਕਿੰਡ ਦੇ ਅੰਦਰ ਅੰਦਰ ਹੀ ਦੂਜੇ ਬੰਦੇ ਨੂੰ ਚੱਲ ਜਾਂਦਾ ਉਹਦੇ ਤਾਂ ਨੈਟ ਇੰਟਰਨੈਟ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਹੁਣ ਤਾਂ ਫੋਨ ਦੇ ਵਿੱਚ ਹੀ ਇੰਟਰਨੈਟ ਕਿੰਨਾ ਕਿੰਨਾ ਸਾਡਾ ਪਿਆ ਰਹਿੰਦਾ ਵੀ ਉਹਨੂੰ ਵਰਤਣ ਵਾਸਤੇ ਸਾਨੂੰ ਸਾਧਣ ਲੱਭਣੇ ਪੈਂਦੇ ਕਿ ਅਸੀਂ ਕਿੱਥੇ ਵਰਤੀਏ ਕਿਉਂਕਿ ਇੰਨਾ ਜ਼ਿਆਦਾ ਨੈੱਟ ਤੇਜ਼ ਹੋ ਚੁੱਕਿਆ ਅਤੇ ਦੂਜਾ ਲੋਕਾਂ ਦੇ ਘਰ ਵਿੱਚ ਆਮ ਹੁਣ ਵਾਈਫਾਈ ਲੱਗ ਗਿਆ ਅਤੇ ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਕੰਮ ਉਹਨਾਂ ਦਾ ਸੌਖਾ ਹੋ ਜਾਂਦਾ ਅਤੇ ਪਹਿਲਾਂ ਦੇ ਇੰਟਰਨੈਟ ਵਿੱਚ ਅਤੇ ਮਤਲਬ ਕੋਈ ਕੰਪ ਯੂ ਨੋ ਅਸੀਂ ਕੁਛ ਕਰ ਹੀ ਨਹੀਂ ਸਕਦੇ ਕੰਪੈਰੀਜ਼ਨ ਹੀ ਨਹੀਂ ਕਰ ਸਕਦੇ ਵੀ ਪਹਿਲਾਂ ਦੇ ਇੰਟਰਨੈਂੱਟ ਇੰਨੇ ਜ਼ਿਆਦਾ ਸਲੋ ਹੁੰਦੇ ਸੀ ਵੀ ਘੰਟੇ ਲੱਗ ਜਾਂਦੇ ਸੀ ਇੱਕ ਫਾਈਲ ਨੂੰ ਡਾਊਨਲੋਡ ਕਰਦੇ ਕਰਦੇ ਅਤੇ ਹੁਣ ਦੇ ਜਿਹੜੇ ਇੰਟਰਨੈਟ ਹੈ ਉਹ ਇੰਨੇ ਜ਼ਿਆਦਾ ਤੇਜ਼ ਨੇ ਇੰਨੇ ਜ਼ਿਆਦਾ ਵਧੀਆ ਨੇ ਕਿ ਤੁਸੀਂ ਇੱਕ ਸੈਕਿੰਡ ਦੇ ਅੰਦਰ ਅੰਦਰ ਤੁਸੀਂ ਇੱਕ ਫਾਈਲ ਤੁਸੀਂ ਆਪਣੀ ਡਾਊਨਲੋਡ ਕਰ ਸਕਦੇ ਹੋ ਜੇ ਤੁਸੀਂ ਕੋਈ ਆਪਣਾ ਪ੍ਰੋ ਪ੍ਰੋਜੈਕਟ ਵਗੈਰਾ ਬਣਾਉਣਾ ਹੋਵੇ ਉਹ ਵੀ ਤੁਸੀਂ ਆਰਾਮ ਨਾਲ ਬਣਾ ਸਕਦੇ ਹੋ ਧੰਨਵਾਦ